ਹੈਲੋ ਹਾਂਜੀ ਸੰਦੀਪ ਕੌਰ ਬੋਲ ਰਹੇ ਹੋ ਹਾਂਜੀ ਮੈਂ ਨਾ ਫਰੂਡ ਵੋ ਵਲੋਗਿੰਗ ਸ਼ੁਰੂ ਕੀਤੀ ਸੀ ਅਤੇ ਮੈਨੂੰ ਥੋੜ੍ਹੀ ਜਿਹੀ ਇੰਫੋਰਮੇਸ਼ਨ ਚਾਹੀਦੀ ਸੀ ਸਟਰੀਟ ਫੂਡ ਹੋ ਗਏ ਫਾਸਟ ਫੂਡ ਹੋ ਗਏ ਅਤੇ ਮੈਂ ਆਪਣੇ ਫਰੈਂਡ ਤੋਂ ਨੰਬਰ ਲਿਆ ਤੁਹਾਡਾ ਹਾਂਜੀ ਮੁਕਤਸਰ ਹਾਂਜੀ ਹਾਂਜੀ ਮੁਕਤਸਰ ਰਿਲੇਟਿਡ ਮਤਲਬ ਜਿਹੜੇ ਵੀ ਇੱਥੇ ਸਟੀਟ ਫੂਡ ਮਿਲਦੇ ਹੈ ਇੱਥੇ ਮੈਨੂੰ ਹਾਂ ਹਾਂਜੀ ਹਾਂਜੀ ਲੋਕਲ ਹਾਂਜੀ ਲੋਕਲ ਤੋਂ ਹੀ ਮੈਨੂੰ ਥੋੜ੍ਹੀ ਜਿਹੀ ਇੰਫੋਰਮੇਸ਼ਨ ਚਾਹੀਦੀ ਸੀ ਅਤੇ ਮੈਂ ਆਪਣੇ ਫਰੈਂਡ ਤੋਂ ਨੰਬਰ ਲਿਆ ਤੁਹਾਡਾ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਜੀ ਉਹਨਾਂ ਨੇ ਕਿਹਾ ਵੀ ਤੁਹਾਨੂੰ ਪੂਰੀ ਇੰਫੋਰਮੇਸ਼ਨ ਹੈਗੀ ਆ ਵੀ ਤੁਹਾਡੇ ਤੋਂ ਪੁੱਛ ਕੇ ਮਤਲਬ ਵੀ ਵਲੋਗਿੰਗ ਕਰ ਸਕਦੇ ਹੋ

ਹਾਂਜੀ ਹਾਂਜੀ ਅੱਛਾ ਜੀ ਹਾਂਜੀ

ਠੀਕ ਹੈ ਠੀਕ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਉਹ ਜ਼ਿਆਦਾਤਰ ਨਾ ਵੈਸੇ ਆਹ ਜਿਹੜੇ ਫਾਸਟ ਫੂਡ ਹੋਗੇ ਜਿਵੇਂ ਅੱਜ ਕੱਲ੍ਹ ਮੋਮੋਜ਼ ਜ਼ਿਆਦਾ ਫੇਮਸ ਆ ਨਾ ਪੀਜਾ ਵਗੈਰਾ ਹੋ ਗਿਆ ਇਹ ਜ਼ਿਆਦਾ ਮਤਲਬ ਡਿਮਾਂਡ ਆ ਰਹੀ ਹੈ ਵੀ ਉਹਨਾਂ 'ਤੇ ਵੀਡੀਓਜ਼ ਬਣਾ ਕੇ ਪਾਓ ਅਤੇ ਡਿਮਾਂਡ ਆ ਰਹੀ ਆ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਹਾਂਜੀ ਹਾਂਜੀ

ਹਾਂਜੀ ਕਿਉਂਕਿ ਜੇ ਵਲੋਗਿੰਗ ਕੀਤੀ ਮਤਲਬ ਉਹਨਾਂ ਨੂੰ ਸਹੀ ਇੰਫੋਰਮੇਸ਼ਨ ਦਿੱਤੀ ਜਿਹੜੀ ਵੀ ਮਤਲਬ ਉੱਥੇ ਕਸਟਮਰ ਜਾਣਦੇ ਜਿਹੜੇ ਮੇਰਾ ਵਲੋਗ ਦੇਖਦੇ ਆਂ ਵੀ ਉਹ ਮਤਲਬ ਵਲੋਗ ਦੇਖਕੇ ਜਾਣਦੇ ਆ ਵੀ ਉਹਨਾਂ ਨੂੰ ਮਤਲਬ ਸਹੀ ਇੰਫੋਰਮੇਸ਼ਨ ਦੇ ਸਕਾਂ ਵੀ ਜੋ ਜੋ ਮੈਂ ਦੱਸਿਆ ਵੀ ਉਹ ਸਹੀ ਸਹੀ ਉਹਨਾਂ ਨੂੰ ਮਿਲੇ ਬਾਅਦ ਵਿੱਚ ਐਏ ਨਾ ਕਹਿਣ ਵੀ ਵਲੋਗ 'ਚ ਐਂਏ ਬੋਲਿਆ ਸੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਜੀ ਕੋਈ ਗੱਲ ਨਹੀਂ ਫਿਰ ਮੈਂ ਨਾ ਤੁਸੀਂ ਮੇਰੇ ਨਾਲ ਇੱਕ ਵਾਰੀ ਚਲ ਜਿਓ ਮਤਲਬ ਹੁਣ ਫੂਡ ਵਲੋਗਿੰਗ ਕਰਨੀ ਤੁਸੀਂ ਜਾਣਦੇ ਹੋਉਗੇ ਤਾਂ ਕਿ ਉਹ ਜਦੋਂ ਵਲੋਗ ਬਣਾਉਣੇ ਹੈ ਕਈ ਵਾਰੀ ਉਹ ਜਿਹੜੇ ਹੁੰਦੇ ਦੁਕਾਨਦਾਰ ਉਹ ਬਣਾਉਣ ਨਹੀਂ ਦਿੰਦੇ ਵੀ ਦਿੱਕਤ ਮੰਨਦੇ ਆ ਇਸ ਚੀਜ਼ ਦੀ ਤੁਹਾਨੂੰ ਜਾਣਦੇ ਹੋਣਗੇ ਹਾਂਜੀ ਤੁਸੀਂ ਚਲ ਜਿਓ ਮੇਰੇ ਨਾਲ ਠੀਕ ਹੈ ਠੀਕ ਠੀਕ ਹੈ